ਰੂਪਨਗਰ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਇੱਥੇ ਗਰਮੀ ਵੀ ਹੁੰਦੀ ਹੈ ਅਤੇ ਫਿਰ ਸਰਦੀਆਂ ਦਾ ਮੌਸਮ ਵੀ ਆਉਂਦਾ ਹੈ ਗਰਮੀ ਵਿੱਚ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਪਰ ਜਦੋਂ ਸਰਵੀ ਸਰਦੀਆਂ ਦਾ ਮੌਸਮ ਆਉਂਦਾ ਹੈ ਤਾਂ ਫਿਰ ਸਰਦੀ ਵੀ ਬਹੁਤ ਜ਼ਿਆਦਾ ਪੈਂਦੀ ਹੈ ਅਤੇ ਫਿਰ ਬਰਸਾਤ ਵੀ ਬਰਸਾਤਾਂ ਦਾ ਮੌਸਮ ਵੀ ਆ ਜਾਂਦਾ ਹੈ ਪਰ ਇਹ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਇੱਥੇ ਪ੍ਰਦੂਸ਼ਣ ਵੀ ਕਾਫੀ ਹੈ ਪ੍ਰਦੂਸ਼ਣ ਦੇ ਕਾਰਨ ਫਿਰ ਕਈ ਤਰ੍ਹਾਂ ਦੇ ਹੋਰ ਵੀ ਨੁਕਸਾਨ ਹੋ ਜਾਂਦੇ ਹਨ ਆਵਾਜਾਈ ਵੀ ਕਾਫੀ ਉਹ ਕਾਫੀ ਵਧਣ ਕਾਰਨ ਪ੍ਰਦੂਸ਼ਣ ਵੱਧ ਜਾਂਦਾ ਹੈ ਫਿਰ ਸਾਫ਼ ਸਫ਼ਾਈ ਦਾ ਵੀ ਕਮੀ ਰਹਿੰਦੀ ਹੈ